ਤਾਰੀ ਅਸੀਂ ਫੌਜ ਦੇ ਵਿੱਚ ਨੌਕਰੀ ਕਰਦੇ ਸੀ ਜਿਹੜੇ ਨਵੇਂ ਰੰਗਰੂਟ ਭਰਤੀ ਹੋ ਕੇ ਜਾਂਦੇ ਨੇ ਉਹਨਾਂ ਨੂੰ ਤਾਰੀ ਸਿਖਾਉਣ ਦੇ ਲਈ ਸਵਿਮਿੰਗ ਪੂਲ 'ਤੇ ਲੈ ਕੇ ਜਾਂਦੇ ਸੀ ਉਹਨਾਂ ਵਿੱਚੋਂ ਕਈ ਤਾਂ ਬਹੁਤ ਚੰਗੇ ਨਿਕਲ ਜਾਂਦੇ ਕਈ ਨਿਕ ਮਾੜੇ ਨਿਕਲ ਜਾਂਦੇ ਸੀ ਜਿਵੇਂ ਜੇ ਕੋਈ ਮਾੜਾ ਹੁੰਦਾ ਸੀ ਉਹ ਡੁੱਬਣ ਤੇਰੀ ਦੇ ਕਿਨਾਰੇ ਪਹੁੰਚ ਜਾਂਦਾ ਸੀ ਤਾਂ ਉਦੋਂ ਉਹਨਾਂ ਦੀ ਮਦਦ ਕਰੀ ਦੀ ਸੀ ਮਦਦ ਹੈ ਕਰੀ ਦੀ ਸੀ ਕਿ ਅਸੀਂ ਆਪ ਤਾਂ ਤਾਰੀ ਨਹੀਂ ਜਾਣਦੇ ਸੀ ਪਰ ਅਸੀਂ ਉਹਨਾਂ ਨੂੰ ਜਾਂ ਤਾਂ ਲੰਬੇ ਬੰਬੂ ਨਾਲ ਬਾਹਰ ਕੱਢਦੇ ਜਾਂ ਫਿਰ ਰੱਸੇ ਸਿੱਟ ਕੇ ਉਹਦੇ ਮ ਕੋਲ ਸਿੱਟ ਦਿੰਦੇ ਅਤੇ ਉਹ ਉਹਨੂੰ ਫੜ ਲੈਂਦਾ ਅਤੇ ਉਹਨੂੰ ਅਸੀਂ ਬਾਹਰ ਕੱਢ ਲੈਂਦੇ ਇਹ ਹੀ ਇੱਕ ਫੌਜ ਦੇ ਵਿੱਚ ਮਦਦ ਦੀ ਲੋੜ ਹੁੰਦੀ ਹੈ ਅਤੇ ਇਵੇਂ ਜਿਵੇਂ ਕਿਵੇਂ ਹੜ੍ਹ ਆਉਂਦੇ ਨੇ ਫੌਜੀ ਲੱਗ ਜਾਂਦੇ ਨੇ ਇਸ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਰੱਸਾ ਨਾਲ ਜਾਂ ਕਿਸ਼ਤੀਆਂ ਨਾਲ ਔਖੀਆਂ ਘੜੀਆਂ ਤੋਂ ਵੀ ਜੀ ਲੰਘਦੇ ਹੋਏ ਆਪਣਾ ਮਦਦ ਕਰਦੇ ਨੇ ਅਸੀਂ ਮੈਂ ਆਪ ਤੁਹਾਨੂੰ ਹੱਡ ਬੀਤੀ ਦੱਸਦਾ ਕਿ ਮੈਂ ਅਰੁਣਾਚਲ ਪ੍ਰਦੇਸ਼ 'ਚ ਸੀਗਾ ਉੱਥੇ ਇੱਕ ਲਾਮਾ ਪਹਾੜੀ ਦੇ ਉੱਤੇ ਡਿੱਗ ਪਿਆ ਅਤੇ ਨਦੀ 'ਚ ਜਾ ਵੱਜਿਆ ਅਸੀਂ ਉਸ ਨਦੀ ਦੇ ਵਿ 'ਤੇ ਨਹਾ ਰਹੇ ਸੀ ਜਦੋਂ ਅਸੀਂ ਉਹਨੂੰ ਵੇਖਿਆ ਤਾਂ ਸਾਡੇ ਕੋਲ ਹੋਰ ਤਾਂ ਕੁਝ ਹੈ ਨਹੀਂ ਸੀ ਪਰ ਸਾਡੇ ਕੋਲ ਪੱਗਾਂ ਸੀ ਅਸੀਂ ਕੱਪੜੇ ਧੋਣ ਗਏ ਸੀ ਉਹਨੂੰ ਪੱਗਾਂ ਸਿੱਟ ਕੇ ਪੱਥਰ ਬੰਨ੍ਹ ਕੇ ਤਾਂ ਉਹਨੇ ਹੱਥ ਪਾਇਆ ਅਤੇ ਉਹਨੂੰ ਅਸੀਂ ਬਾਹਰ ਕੱਢ ਲਿਆ ਸੀ